ਜਾਨਵਰਾਂ ਦੀ ਦੇਖਭਾਲ ਦੇ ਲਈ ਸਾਡੇ ਬਜ਼ੁਰਗਾਂ ਵੱਲੋਂ ਕਈ ਤਰ੍ਹਾਂ ਦੇ ਕੁਦਰਤੀ ਅਤੇ ਜੈਵਿਕ ਢੰਗ ਨੇ ਜਿਹੜੇ ਉਹ ਦੱਸੇ ਜਾਂਦੇ ਹਨ ਸਾਡੇ ਬਜ਼ੁਰਗਾਂ ਦੇ ਕਹਿਣ ਦੇ ਅਨੁਸਾਰ ਹਮੇਸ਼ਾਂ ਹੀ ਪਸ਼ੂਆਂ ਦੀ ਖੁਰਲੀ ਦੇ ਵਿੱਚ ਲੂਣ ਦਾ ਹੋਣਾ ਲਾਜ਼ਮੀ ਹੈ ਲੂਣ ਹੈ ਜਿਹੜਾ ਜੇਕਰ ਪਾਕਿਸਤਾਨੀ ਲੂਣ ਹੋਵੇ ਤਾਂ ਜਿਆਦਾ ਵਧੀਆ ਰਹਿੰਦਾ ਹੈ ਇਸ ਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਸਰਦੀਆਂ ਦੇ ਵਿੱਚ ਪਸ਼ੂ ਨੇ ਜਿਹੜੇ ਉਹਨਾਂ ਨੂੰ ਪਾਣੀ ਦੀ ਪਿਆਸ ਘੱਟ ਲੱਗਦੀ ਹੈ ਪਰ ਜਦੋਂ ਉਹ ਲੂਣ ਨੂੰ ਚੱਟਦੇ ਹਨ ਤਾਂ ਉਹਨਾਂ ਨੂੰ ਪਿਆਸ ਲੱਗ ਜਾਂਦੀ ਹੈ ਜਿਸਦੇ ਨਾਲ ਕਿ ਪਸ਼ੂ ਨੇ ਜਿਹੜੇ ਉਹ ਢਿੱਡ ਭਰ ਕੇ ਪਾਣੀ ਪੀ ਲੈਂਦੇ ਹਨ ਇਸ ਤੋਂ ਬਿਨਾਂ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਅ ਦੇ ਲਈ ਤੂੰ ਤੂੜੀ ਦਾ ਤੂੜੀ ਦਾ ਧੂੰਆਂ ਜਾਂ ਫਿਰ ਨਿੰਮ ਦੇ ਪੱਤਿਆਂ ਦਾ ਧੂੰਆਂ ਹੈ ਜਿਹੜਾ ਉਹ ਬਹੁਤ ਕੀਤਾ ਜਾਂਦਾ ਹੈ ਜਿਹੜਾ ਕਿ ਪਸ਼ੂਆਂ ਨੂੰ ਬਹੁਤ ਹੀ ਆਰਾਮ ਦਿੰਦਾ ਹੈ ਇਸ ਤੋਂ ਬਿਨਾਂ ਪਸ਼ੂਆਂ ਨੂੰ ਕੱਚੇ ਦੇ ਵਿੱਚ ਬੰਨਣਾ ਵੀ ਬਹੁਤ ਹੀ ਲਾਭਕਾਰੀ ਹੁੰਦਾ ਹੈ ਪ ਕੱਚੇ ਪੱਕੇ ਦੇ ਫਰਸ਼ ਦੇ ਉੱਤੇ ਖੜ੍ਹੇ ਰਹਿਣ ਦੇ ਨਾਲ ਕਈ ਵਾਰ ਪਸ਼ੂ ਨੇ ਜਿਹੜੇ ਉਹਨਾਂ ਨੂੰ ਗਰਮੀਆਂ ਦੇ ਵਿੱਚ ਸੇਕ ਦੇ ਨਾਲ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਗਰਮ ਰਹਿੰਦਾ ਹੈ ਪਰ ਜਦੋਂ ਅਸੀਂ ਉਹਨਾਂ ਨੂੰ ਕੱਚੇ ਦੇ ਵਿੱਚ ਬੰਨਦੇ ਹਾਂ ਤਾਂ ਇਹ ਕੁਦਰਤੀ ਗੱਲ ਹੈ ਕਿ ਜਿਹੜੀ ਮਿੱਟੀ ਹੈ ਸਾਡੀ ਉਹ ਟੈਂਪਰੇਚਰ ਦੇ ਅਨੁਸਾਰ ਠੰਡੀ ਹੋ ਜਾਂਦੀ ਹੈ ਅਤੇ ਸਾਡੇ ਜਿਹੜੇ ਪਸ਼ੂ ਨੇ ਉਹ ਗਰਮੀਆਂ ਦੇ ਵਿੱਚ ਗਰਮ ਲੂ ਤੋਂ ਬੱਚ ਜਾਂਦੇ ਹਨ ਇਸ ਤਰ੍ਹਾਂ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਪੱਕੇ ਫਰਸ਼ ਹੁੰਦੇ ਨੇ ਬਹੁਤ ਜਿਆਦਾ ਠੰਡ ਹੈ ਜਿਹੜੀ ਉਹ ਪਸ਼ੂਆਂ ਨੂੰ ਮਹਿਸੂਸ ਕਰਦੇ ਹਨ ਉਹਨਾਂ ਪਸ਼ੂ ਬਹੁਤ ਠੰਡ ਮਹਿਸੂਸ ਕਰਦੇ ਹਨ ਪੱਕੇ ਫਰਸ਼ਾਂ ਤੋਂ ਪਰ ਇਸ ਦੇ ਉਲਟ ਜੇਕਰ ਅਸੀਂ ਉਹਨਾਂ ਨੂੰ ਕੱਚੇ 'ਚ ਬੰਨਾਂਗੇ ਤਾਂ ਉਹਨਾਂ ਨੂੰ ਨਿੱਘ ਮਿਲਦਾ ਹੈ ਇਸ ਤਰ੍ਹਾਂ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਹਨ ਜਿਹੜੇ ਕਿ ਅਸੀਂ ਵਰਤ ਕੇ ਆਪਣੇ ਪਸ਼ੂਆਂ ਦੀ ਸਹੀ ਤਰੀਕੇ ਦੇ ਨਾਲ ਸਾਂਭ ਸੰਭਾਲ ਹੈ ਜਿਹੜੀ ਉਹ ਕਰ ਸਕਦੇ ਹਾਂ ਪਸ਼ੂਆਂ ਦੀ ਨੂੰ ਚੰਗੀ ਸਿਹਤ ਦੇ ਲਈ ਅਸੀਂ ਉਹਨਾਂ ਨੂੰ ਵੜੇਵਿਆਂ ਦੀ ਖਲ਼ ਸਰ੍ਹੋਂ ਦੀ ਖਲ਼ ਤਿਲਾਂ ਦੀ ਖਲ਼ ਸਮੇਂ ਸਮੇਂ 'ਤੇ ਦੇ ਸਕਦੇ ਹਾਂ ਜਦੋਂ ਸ ਸਾਡੇ ਪਸ਼ੂ ਨੇ ਜਿਹੜੇ ਸਰਦੀਆਂ ਵਿੱਚ ਉਹਨਾਂ ਨੂੰ ਅਸੀਂ ਵੜੇਵਿਆਂ ਦੀ ਖਲ਼ ਖਿਲਾ ਸਕਦੇ ਹਾਂ ਇਸ ਦੇ ਉਲਟ ਗਰਮੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਸਰ੍ਹੋਂ ਦੀ ਖਲ਼ ਹੈ ਜਿਹੜੀ ਉਹ ਪਾ ਸਕਦੇ ਹਾਂ ਜਿਹਦੇ ਨਾਲ ਕਿ ਸਾਡੇ ਪਸ਼ੂ ਨੇ ਜਿਹੜੇ ਉਹ ਤੰਦਰੁਸਤ ਰਹਿੰਦੇ ਹਨ ਅਤੇ ਤਾਂ ਜਦੋਂ ਸਾਡੇ ਪਸ਼ੂ ਤੰਦਰੁਸਤ ਹੁੰਦੇ ਹਨ ਤਾਂ ਉਹ ਸਾਨੂੰ ਵਧੇਰੇ ਦੁੱਧ ਦਿੰਦੇ ਹਨ ਅਤੇ ਸ